ਜਦੋਂ ਮੈਂ ਪੰਦਰਾਂ ਸਾਲਾਂ ਦਾ ਸੀ ਉਸ ਸਮੇਂ ਵਿੱਚ ਮੈਨੂੰ ਆਪਣਾ ਪਹਿਲਾ ਮੋਬਾਈਲ ਫੋਨ ਮਿਲਿਆ ਸੀ ਇਹ ਮੋਬਾਇਲ ਫੋਨ ਮੈਨੂੰ ਮੇਰੇ ਘਰਦਿਆਂ ਨੇ ਲੈ ਕੇ ਦਿੱਤਾ ਸੀ ਅਤੇ ਇਹ ਮੈਕਸ ਕੰਪਨੀ ਦਾ ਸੀ ਉਸ ਸਮੇਂ ਦੇ ਅਨੁਸਾਰ ਇਹ ਮੋਬਾਇਲ ਕਾਫੀ ਆਧੁਨਿਕ ਟੈਕਨੋਲੋਜੀ ਦਾ ਸੀਗਾ ਇਹ ਬਟਨਾਂ ਅਤੇ ਟੱਚ ਸਕ੍ਰੀਮ ਦੋਨੋਂ ਵਿੱਚ ਉਪਲੱਬਧ ਸੀ ਅਤੇ ਇਸ ਮੋਬਾਇਲ ਵਿੱਚ ਮੈਂ ਅਲੱਗ ਅਲੱਗ ਪ੍ਰਕਾਰ ਦੀਆਂ ਗੇਮਾਂ ਖੇਡਦਾ ਸੀ ਅਤੇ ਸਭ ਤੋਂ ਜ਼ਿਆਦਾ ਸਮਾਂ ਮੈਂ ਇਸ ਮੋਬਾਈਲ ਵਿੱਚ ਗੇਮਾਂ ਖੇਡ ਕੇ ਹੀ ਸਾਰਿਆ ਹੈ ਇਸ ਮੋਬਾਈਲ ਵਿੱਚ ਔਰ ਵੀ ਕਾਫੀ ਤਰੀਕੇ ਦੀ ਸਹੂਲਤਾਂ ਸੀਗੀਆਂ ਜਿਸ ਪ੍ਰਕਾਰ ਮੈਂ ਇਹਦੇ ਵਿੱਚ ਤਸਵੀਰ ਵੀ ਖਿੱਚ ਸਕਦਾ ਸੀ ਅਤੇ ਇਸ ਵਿੱਚ ਤਸਵੀਰ ਦੀ ਕੁਆਲਿਟੀ ਕਾਫੀ ਹੀ ਜ਼ਿਆਦਾ ਵਧੀਆ ਸੀ ਇਸ ਫੋਨ ਵਿੱਚ ਟੱਚ ਸਕਰੀਨ ਹੋਣ ਦੇ ਨਾਲ ਨਾਲ ਬਟਨ ਵੀ ਸੀਗੇ ਜਿਸ ਕਰਕੇ ਇਸ ਨੂੰ ਇਸਤੇਮਾਲ ਕਰਨਾ ਕਾਫੀ ਆਸਾਨ ਸੀ ਅਤੇ ਇਸ ਮੋਬਾਈਲ ਨਾਲ ਮੇਰੀ ਕਾਫੀ ਯਾਦਾਂ ਵੀ ਜੁੜੀਆਂ ਹਨ ਜਦੋਂ ਮੈਂ ਛੋਟਾ ਸੀਗਾ ਉਸ ਟਾਈਮ 'ਤੇ ਮੈਂ ਇਹ ਮੋਬਾਈਲ ਫੋਨ ਆਪਣੇ ਨਾਲ ਰੱਖਦਾ ਸੀ ਹਰ ਟਾਈਮ ਅਤੇ ਜਦੋਂ ਵੀ ਮੈਂ ਖੇਡਣ ਜਾਂਦਾ ਸੀ ਤਾਂ ਮੈਂ ਇਸ ਮੋਬਾਈਲ ਫੋਨ ਨੂੰ ਆਪਣੇ ਨਾਲ ਲੈ ਕੇ ਜਾਂਦਾ ਸੀ ਅਤੇ ਖੇਡਦੇ ਸਮੇਂ ਮੈਂ ਕਾਫੀ ਤਰੀਕੇ ਦੀਆਂ ਤਸਵੀਰਾਂ ਖਿੱਚਦਾ ਸੀ ਇਸ ਮੋਬਾਈਲ ਦੇ ਰਾਹੀਂ ਅਤੇ ਆਪਣੇ ਦੋਸਤਾਂ ਨਾਲ ਮੈਂ ਕਾਫੀ ਸਾਰੀਆਂ ਯਾਦਾਂ ਬਣਾਈਆਂ ਹਨ ਇਸ ਮੋਬਾਇਲ ਦੇ ਹੋਣ ਕਰਕੇ ਅਤੇ ਇਸ ਮੋਬਾਈਲ ਫੋਨ ਵਿੱਚ ਇੱਕ ਹੋਰ ਆਧੁਨਿਕ ਤਕਨੀਕ ਫੀਚਰ ਅਵੇਲੇਬਲ ਸੀ ਇਸ ਵਿੱਚ ਆਪਾਂ ਵੀਡੀਓ ਵੀ ਰਿਕਾਰਡ ਕਰ ਸਕਦੇ ਸੀ ਅਤੇ ਮੈਂ ਇਸ ਮੋਬਾਈਲ ਦੇ ਰਾਹੀਂ ਕਾਫੀ ਵੀਡੀਓਜ਼ ਵੀ ਰਿਕਾਰਡ ਕੀਤੀਆਂ ਹਨ ਜੋ ਅੱਜ ਦੇ ਸਮੇਂ ਵਿੱਚ ਮੈਨੂੰ ਕਾਫੀ ਯਾਦ ਆਉਂਦੀ ਹੈ ਅਤੇ ਇਸ ਮੋਬਾਇਲ ਫੋਨ ਵਿੱਚ ਇਸ ਮੋਬਾਈਲ ਫੋਨ ਨੇ ਮੈਨੂੰ ਸਵੇਰੇ ਜਲਦੀ ਉੱਠਣ ਲਈ ਇਹ ਕਾਫੀ ਸਹਾਇਤਾ ਕੀਤੀ ਹੈ ਕਿਉਂਕਿ ਇਸ ਵਿੱਚ ਅਲਾਰਮ ਦਾ ਫੀਚਰ ਸੀ ਜਿਸ ਨੂੰ ਆਪਾਂ ਰਾਤੀਂ ਮੋਬਾਇਲ ਫੋਨ ਵਿੱਚ ਸੈੱਟ ਕਰਕੇ ਸੌ ਜਾਦੇ ਹਨ ਅਤੇ ਇਹ ਸਾਨੂੰ ਸਵੇਰੇ ਵਕਤ ਦੇ ਅਨੁਸਾਰ ਉਠਾ ਦਿੰਦਾ ਸੀ ਅਤੇ ਇਸ ਮੋਬਾਇਲ ਫੋਨ ਦੀ ਵਰਤੋਂ ਮੈਂ ਕਾਫੀ ਸਾਲ ਕੀਤੀ ਹੈ ਜਦੋਂ ਮੈਂ ਪੰਦਰਾਂ ਸਾਲਾਂ ਦਾ ਸੀ ਉਸ ਸਮੇਂ ਮੈਨੂੰ ਇਹ ਮੋਬਾਇਲ ਫੋਨ ਮਿਲਿਆ ਸੀ ਅਤੇ ਅਠਾਰਾਂ ਸਾਲ ਦੇ ਉਮਰ ਤੱਕ ਮੈਂ ਇਸ ਮੋਬਾਇਲ ਫੋਨ ਦੀ ਵਰਤੋਂ ਕੀਤੀ ਹੈ ਅਤੇ ਹਜੇ ਵੀ ਮੇਰੇ ਕੋਲ ਇਹ ਮੋਬਾਇਲ ਪਿਆ ਹੈ ਅਤੇ ਇਹਦੇ ਨਾਲ ਮੇਰੀ ਕਾਫੀ ਯਾਦਾਂ ਜੁੜੀਆਂ ਹਨ